ਹੈਲੋ ਸਤਿ ਸ਼੍ਰੀ ਅਕਾਲ ਸਰ ਸਰ ਤੁਸੀਂ ਬੋਬੀ ਟੈਲੀਕੋਮ ਤੋਂ ਬੋਲ ਰਹੇ ਹੋ ਅਤੇ ਜਿਵੇਂ ਕਿ ਸਰ ਮੈਂ ਤੁਹਾਡੇ ਤੋਂ ਔਨਲਾਈਨ ਔਡਰ ਕਰਵਾਇਆ ਸੀਗਾ ਵੀਵੋ ਦਾ ਫੋਨ ਹਾਂਜੀ ਅਤੇ ਉਹ ਬਹੁਤ ਹੀ ਵਧੀਆ ਨਿਕਲਿਆ ਸਰ ਜਿਵੇਂ ਉੱਥੇ ਟਾਈਮ ਸ਼ੋ ਕਰ ਰਿਹਾ ਸੀਗਾ ਵੀ ਚਾਰ ਦਿਨਾਂ 'ਚ ਮਿਲੂਗਾ ਬਟ ਇਹ ਸਮੇਂ ਤੋਂ ਪਹਿਲਾਂ ਦੋ ਦਿਨਾਂ 'ਚ ਮਿਲ ਗਿਆ ਸਾਨੂੰ ਅਤੇ ਮੈਂ ਬਹੁਤ ਹੀ ਖੁਸ਼ ਹਾਂ ਅਤੇ ਨਾਲ ਤੁਸੀਂ ਮੇਰੇ ਲਈ ਗਿਫਟ ਵੀ ਭੇਜਿਆ ਸੀਗਾ ਅਤੇ ਦੂਜੀ ਗੱਲ ਇਹ ਹੈ ਸਰ ਕਿ ਇਹ ਫੋਨ ਬਹੁਤ ਵਧੀਆ ਜਿੰਨਾ ਅਸੀਂ ਦੇਖਦੇ ਸੀ ਨੈਟ ਤੋਂ ਉਹਤੋਂ ਬਹੁਤ ਜ਼ਿਆਦਾ ਵਧੀਆ ਨਿਕਲਿਆ ਕਿਉਂਕਿ ਇਹਦਾ ਕੈਮਰਾ ਕੁਆਲਿਟੀ ਹੋ ਗਈ ਬੈਟਰੀ ਪੈਕ ਪੈਕਅਪ ਹੋ ਗਿਆ ਅਤੇ ਬਾਕੀ ਸਾਊਂਡ ਕੁਆਲਟੀ ਹੋ ਗਈ ਅਤੇ ਸਕਰੀਨ ਸਾਈਜ ਬਹੁਤ ਹੀ ਵਧੀਆ ਸਰ ਬੜਾ ਸਮੂਥਲੀ ਚੱਲਦਾ ਪਿਆ ਸੋ ਮੈਨੂੰ ਬਹੁਤ ਵਧੀਆ ਲੱਗਿਆ ਕਿ ਤੁਸੀਂ ਇੰਨਾ ਵਧੀਆ ਮਤਲਬ ਸਾਡੇ ਲਈ ਮੋਬਾਇਲ ਭੇਜਿਆ ਦੂਜੀ ਗੱਲ ਇਹ ਸਰ ਮੈਂ ਤੁਹਾਨੂੰ ਇੱਕ ਹੋਰ ਰਿਕੁਐਸਟ ਕਰਨਾ ਚਾਹੁੰਦਾ ਕਿ ਅਗਲੀ ਵਾਰ ਤੁਸੀਂ ਇੱਦਾਂ ਦਾ ਕੋਈ ਹੋਰ ਮਾਡਲ ਆਵੇ ਜਾਂ ਇੱਦਾਂ ਦਾ ਕੋਈ ਵਧੀਆ ਫੋਨ ਆਵੇ ਤੁਸੀਂ ਜ਼ਰੂਰ ਦੱਸਣਾ ਇੱਦਾਂ ਦੇ ਘੈਂਟ ਫੋਨ ਘੱਟ ਹੀ ਲੱਭਦੇ ਸਾਨੂੰ ਤਾਂ ਕਿ ਅਸੀਂ ਆਪਣੇ ਫੈਮਲੀ ਆਪਣੇ ਦੋਸਤਾਂ ਨੂੰ ਵੀ ਇਹਦੇ ਦੇ ਨਾਲ ਲੈ ਕੇ ਦੇਈਏ ਮੇਰੇ ਕਾਫ਼ੀ ਲੋਕਾਂ ਨੂੰ ਚਾਹੀਦੇ ਆ ਬਹੁਤ ਕਲੋਜ਼ ਨੇ ਤਾਂ ਕਿ ਮੈਂ ਕਿਹਾ ਇੱਦਾ ਦਾ ਕੋਈ ਘੈਂਟ ਜਿਹਾ ਫੋਨ ਉਹਨਾਂ ਨੂੰ ਵੀ ਲੈ ਕੇ ਦੇਈਏ ਜ਼ਰੂਰ ਦੱਸਣਾ ਸਰ ਥੈਂਕ ਯੂ ਸਰ